ਮੇਰੇ ਖੇਤਰ ਵਿੱਚ ਬਹੁਤ ਕੁਦਰਤੀ ਸਰੋਤ ਪਾਏ ਜਾਂਦੇ ਹਨ ਉਹ ਹਨ ਕੋਲਾ ਆਇਰਨ ਲੀਥੀਅਮ ਐਲੂਮੀਨੀਅਮ ਬਾਕਸਾਈਡ ਡਾਇਮੰਡ ਇਹ ਆਇਰਨ ਲੋਹੇ ਦਾ ਸਮਾਨ ਬਣਾਉਣ ਲਈ ਵਰਤਿਆ ਜਾਂਦਾ ਹੈ ਲੋਹੇ ਦਾ ਕੱਚਾ ਮਾਲ ਬਣਾਉਣ ਲਈ ਵਰਤਿਆ ਜਾਂਦਾ ਹੈ ਅਤੇ ਇਹ ਕਈ ਫੈਕਟਰੀਆਂ ਵਿੱਚੋਂ ਸਪਲਾਈ ਕੀਤਾ ਜਾਂਦਾ ਹੈ ਇਸ ਦੀਆਂ ਮਾਈਨਿੰਗ ਖੋਦੀਆਂ ਜਾਂਦੀਆਂ ਹਨ ਜਿਸ ਵਿੱਚ ਬਹੁਤ ਸਾਰਾ ਲੋਹਾ ਨਿਕਲਦਾ ਹੈ ਕੋਲਾ ਇਹ ਟਰੇਨਾਂ ਚਲਾਉਣ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ ਬਿਜਲੀ ਬਣਾਉਣ ਵਿੱਚ ਇਸਦੀ ਵਰਤੋਂ ਕੀਤੀ ਜਾਂਦੀ ਹੈ ਲੀਥੀਅਮ ਇਹ ਐਰੋਪਲੇਨ ਬਣਾਉਣ ਲਈ ਇਸਨੂੰ ਵਰਤੇ ਜਾਂਦੇ ਕਿਉਂਕਿ ਇਹ ਬਹੁਤ ਮਜ਼ਬੂਤ ਤੱਤ ਹੁੰਦਾ ਹੈ ਅਤੇ ਇਨ੍ਹਾਂ ਦੀਆਂ ਮਾਇਨਿੰਗਾਂ ਖੋਦੀਆਂ ਜਾਂਦੀਆਂ ਹਨ ਅਤੇ ਆਲੂਮੀਨੀਅਮ ਦੇ ਭਾਂਡੇ ਬਣਾਏ ਜਾਂਦੇ ਹਨ ਜੋ ਸਾਡੇ ਘਰਾਂ ਵਿੱਚ ਵਰਤੇ ਜਾਂਦੇ ਹਨ ਬਕਸਾਈਡ ਇਹ ਸੜਕਾਂ ਬਣਾਉਣ ਲਈ ਵਰਤੇ ਜਾਂਦੇ ਹਨ ਇਹ ਬਹੁਤ ਮਜ਼ਬੂਤ ਧਾਤੂ ਹੁੰਦਾ ਹੈ ਡਾਇਮੰਡ ਡਾਇਮੰਡ ਦੀਆਂ ਮਾਈਨਿੰਗ ਖੋਦੀਆਂ ਜਾਂਦੀਆਂ ਹਨ ਜਿਸ ਵਿੱਚੋਂ ਬਹੁਤ ਸਾਰਾ ਡਾਇਮੰਡ ਨਿਕਲਦਾ ਹੈ ਅਤੇ ਇਸ ਨੂੰ ਤਰਾਸ਼ਿਆ ਜਾਂਦਾ ਅਤੇ ਇਸਨੂੰ ਡਾਇਮੰਡ ਦਾ ਅਕਾਰ ਦਿੱਤਾ ਜਾਂਦਾ ਹੈ ਜਿਸ ਨਾਲ ਇਹ ਬਹੁਤ ਖੂਬਸੂਰਤ ਲੱਗਦਾ ਹੈ ਅਤੇ ਇਹ ਅੱਗੇ ਵੇਚਿਆ ਜਾਂਦਾ ਹੈ ਬਹੁਤ ਭਾਰੀ ਕੀਮਤ 'ਤੇ ਇਸਨੂੰ ਵੇਚਿਆ ਜਾਂਦਾ ਹੈ